ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਮਨਰਾਜ ਰੋਮ ਰੋਲ ਨੰਬਰ ਟਵੈਂਟੀ ਸਿਕਸ ਹੈ ਨਾ ਉਸਦਾ ਮੈਮ ਜਿਹੜੀ ਇੰਗਲਿਸ਼ ਹੈ ਇੰਗਲਿਸ਼ ਥੋੜ੍ਹੀ ਜੀ ਗ੍ਰੈਮੈਟੀਕਲ ਮਿਸਟੇਕਸ ਨੇ ਹੈਗੀਆਂ ਜਿਵੇਂ ਨਾਊਨ 'ਚ ਹੋਗੀਆਂ ਐਡਵਰਵ 'ਚ ਹੋਗੀਆਂ ਹੈ ਨਾ 'ਚ ਹੋਗੀਆਂ ਅਦਰਵਾਈਜ਼ ਲਿਟਰੇਚਰ ਤਾਂ ਠੀਕ ਹੈ ਮੈਮ ਅਤੇ ਮੈਥ ਦੇ ਵਿੱਚ ਥੋੜ੍ਹੀ ਜੀ ਹੈਗੀ ਆ ਉਹਦੀ ਮਤਲਬ ਸਿਲੀ ਮਿਸਟੇਕਸ ਕਰਦਾ ਜਿਵੇਂ ਕੋਈ ਆਪਾਂ ਐਡ ਹੋ ਗਿਆ ਸਬਸਕ੍ਰਿਪਸ਼ਨ ਹੋ ਗਿਆ ਇਹਦੇ ਵਿੱਚ ਅਦਰਵਾਈਜ ਠੀਕ ਹੈ ਮੈਮ ਅਤੇ ਸਾਇੰਸ ਦੇ ਵਿੱਚ ਥੋੜ੍ਹੀ ਜਿਹੀ ਡਾਇਗਰਾਮ ਦੀ ਪ੍ਰੋਬਲਮ ਹੈ ਉਹਦੀ ਅਦਰਵਾਈਜ ਠੀਕ ਹੈ ਮੈਮ ਅਤੇ ਹਾਂਜੀ ਹਾਂਜੀ ਹਾਂਜੀ ਪੰਜਾਬੀ 'ਚ ਤਾਂ ਬਹੁਤ ਅੱਛੀ ਪੰਜਾਬੀ ਲਿਖ ਲੈਂਦਾ ਮੈਮ ਇਹ ਹਾਂਜੀ ਅਤੇ ਮੈਮ ਥੋੜ੍ਹੀ ਹਿੰਦੀ 'ਚ ਹੈਗੀ ਹੈ ਥੋੜ੍ਹੀ ਮਾਤਰਾਵਾਂ ਦੀ ਪ੍ਰੋਬਲਮ ਅਤੇ ਉਹ 'ਚ ਜਿਵੇਂ ਨਾ ਛੋਟੀ ਈ ਬੜੀ ਈ ਹੋ ਗਈ ਹੈ ਨਾ ਮੈਮ ਤੁਸੀਂ ਨਾ ਉਹਦੇ ਵਾਸਤੇ ਇਹ ਕਰ ਸਕਦੇ ਹੋ ਵੀ ਇਹ ਤੋਂ ਰੋਜ਼ ਨਾ ਇੱਕ ਪੇਜ ਲਿਖਵਾਓ ਹੈ ਨਾ ਅਤੇ ਇਹ ਨਾ ਉਹਦੀ ਰਿਟਨ ਪ੍ਰੈਕਟਿਸ ਹੋਵੇਗੀ ਅਤੇ ਜਿਹੜੀਆਂ ਮਾਤਰਾਵਾਂ ਦੀ ਪ੍ਰੋਬਲਮ ਹੋਵੇਗੀ ਉਹ ਠੀਕ ਹੋਜੂਗੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਗੇਮਸ 'ਚ ਮੈਮ ਗੇਮਸ 'ਚ ਅੱਛਾ ਪਰਫੋਮ ਕਰ ਰਿਹਾ ਮੈਮ ਹਾਂਜੀ ਗੇਮਸ 'ਚ ਤਾਂ ਠੀਕ ਹੈ ਬਹੁਤ ਅੱਛਾ ਹਾਂਜੀ ਅਤੇ ਮੈਮ ਬਾਕੀ ਜਿਵੇਂ ਆਪਾਂ ਓਵਰਆਲ ਦੇਖਦੇ ਹਾਂ ਹੁਣ ਅਸੀਂ ਕਰਵਾਉਂਦੇ ਹਾਂ ਕੋਂਪੀਟੀਸ਼ਨ ਵਗੈਰਾ ਹੈ ਨਾ ਸਟੋਰੀ ਟੈਲਿੰਗ ਹੋ ਗਿਆ ਹੈ ਨਾ ਪੋਈਮ ਵਗੈਰਾ ਹੋਗਿਆ ਓਹਦੇ ਵਿੱਚ ਬਹੁਤ ਅੱਛਾ ਕੋਂਨਫੀਡੈਂਸ ਹੈ ਦੇਖੋ ਮੇਨ ਤਾਂ ਬੱਚੇ 'ਚ ਹੁੰਦਾ ਨਾ ਵੀ ਕੋਂਨਫੀਡੈਂਸ ਹੋਵੇ ਉਹ ਅੱਛਾ ਹੈ ਮੈਮ ਹਾਂਜੀ ਮੈਮ ਹੋਰ ਕੋਈ ਕੁਐਰੀ ਜੀ ਹਾਂ ਮੈਮ ਓਵਰਆਲ ਹਾਂ ਹਾਂਜੀ ਸਾਰੇ ਸਬਜੈਕਟਸ 'ਚੋਂ ਦੇਖੀਏ ਤਾਂ ਬਹੁਤ ਅੱਛੀ ਹੈ ਓਵਰਆਲ ਦੇਖੋ ਸਿਲੀ ਮਿਸਟੇਕਸ ਤਾਂ ਦੇਖੋ ਬੱਚੇ ਕਰੀ ਜਾਂਦੇ ਆ ਬਟ ਇਹ ਆ ਵੀ ਚਲੋ ਥੋੜ੍ਹੀ ਜਿਹੀ ਹਿੰਦੀ 'ਚ ਹੈਗੀ ਹੈ ਉਹ ਤੁਸੀਂ ਕਵਰ ਅਪ ਕਰ ਲਉ ਨਾ ਪ੍ਰੈਕਟਿਸ ਕਰਾ ਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਠੀਕ ਹੈ